ਸਾਨੂੰ ਦੂਸਰੇ ਪੰਜਾਬਾਂ ਦੂਸਰੇ ਦੇਸ਼ਾਂ ਦੇ ਨਾਲੋਂ ਪੰਜਾਬ ਦਾ ਮੀਡੀਆ ਜਿਆਦਾ ਵਧੀਆ ਲੱਗਦਾ ਹੈ ਕਿਉਂਕਿ ਪੰਜਾਬ ਦਾ ਜੀ ਪੰਜਾਬੀ ਚੈਨਲ ਤੇ ਜਾਂ ਜੀ ਹਰਿਆਣਾ ਨਿਊਜ਼ ਤੇ ਬਹੁਤ ਹੀ ਵਧੀਆ ਨਿਊਜ਼ ਆਉਂਦੀਆਂ ਤੇ ਹੋਰ ਦੇਸ਼ਾਂ ਦੇ ਵਿੱਚੋਂ ਆਉਣ ਵਾਲੀ ਨਿਊਜ਼ ਬਾਰੇ ਸਾਨੂੰ ਇਨਾ ਕੁਝ ਖਾਸ ਨਹੀਂ ਪਤਾ ਲੱਗਦਾ ਇਸ ਲਈ ਅਸੀਂ ਆਪਣੇ ਪੰਜਾਬੀ ਮੀਡੀਆ ਵਾਲਿਆਂ ਨੂੰ ਹੀ ਜਿਆਦਾ ਉਹ ਕਰਦੇ ਆ